ਜੀ ਹਾਂ ਮੇਰੇ ਕੋਲ ਗੁਪਤ ਸਮੱਗਰੀ ਹੈ ਇਸ ਨਾਲ ਜੋ ਅਸੀਂ ਪਕਵਾਨ ਬਣਾਉਂਦੇ ਹਾਂ ਉਹਨਾਂ ਨੂੰ ਜ਼ਿਆਦਾ ਸਵਾਦ ਬਣਾ ਸਕਦੇ ਹਾਂ ਮੇਰਾ ਇੱਕ ਦੋਸਤ ਬਾਹਰੋਂ ਆਇਆ ਸੀ ਪਿਛਲੇ ਸਾਲ ਉਹ ਬਾਹਰ ਯਾਨੀ ਕਿ ਇੱਕ ਵਿਦੇਸ਼ ਵਿੱਚ ਇੱਕ ਹੋਟਲ 'ਤੇ ਕੰਮ ਕਰਦਾ ਸੀ ਉਹ ਬਹੁਤ ਵਧੀਆ ਪਕਵਾਨ ਤਿਆਰ ਕਰਦਾ ਸੀ ਉਸਨੇ ਮੈਨੂੰ ਕਿਹਾ ਕਿ ਮੇਰੇ ਕੋਲ ਗੁਪਤ ਸਮੱਗਰੀ ਹੈ ਉਸ ਨੇ ਮੈਨੂੰ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇੱਕ ਵਧੀਆ ਮਸਾਲਾ ਤਿਆਰ ਕੀਤਾ ਹੈ ਜਿਸ ਨੂੰ ਖਾਣਾ ਬਣਾ ਕੇ ਸਭ ਤੋਂ ਮਗਰੋਂ ਪਾਉਣਾ ਹੁੰਦਾ ਹੈ ਸੋ ਉਹ ਟੋਟਕਾ ਮੈਂ ਵੀ ਘਰ ਵਿੱਚ ਵਰਤ ਕੇ ਦੇਖਿਆ ਉਸ ਨੇ ਮੈਨੂੰ ਮਸਾਲਾ ਬਣਾਉਣ ਦਾ ਚੰਗਾ ਢੰਗ ਦੱਸ ਦਿੱਤਾ ਸੀ ਹੁਣ ਮੈਂ ਪਕਵਾਨ ਵਿੱਚ ਉਸ ਦੀ ਵਰਤੋਂ ਕਰਦਾ ਹਾਂ ਅਤੇ ਸਾਰਾ ਪਰਿਵਾਰ ਵਾਲੇ ਉਂਗਲਾਂ ਹੀ ਚੱਟ ਦੇ ਰਹਿ ਜਾਂਦੇ ਹਨ